ਸਤਿ ਸ਼੍ਰੀ ਅਕਾਲ ਬਾਈ ਮੈਂ ਅਸ਼ੋਕ ਗੱਲ ਕਰ ਰਿਹਾ ਹੋਰ ਤੂੰ ਸੁਣਾ ਤੇਰਾ ਕੀ ਹਾਲ ਆ ਬਾਈ ਮੈਂ ਜੋ ਤੂੰ ਮੈਨੂੰ ਡਰਾਈਵਰ ਦਾ ਨੰਬਰ ਸੈਂਡ ਕੀਤਾ ਸੀਗਾ ਮੈਂ ਉਹਦੇ 'ਤੇ ਕੋਲ 'ਤੇ ਕੀਤਾ ਆ ਪਰ ਮੈਨੂੰ ਡਰਾਈਵਰ ਬਾਰੇ ਤੇਰੇ ਕੋਲੋਂ ਕੁਛ ਪੁੱਛਣਾ ਸੀਗਾ ਅਤੇ ਤੈਨੂੰ ਦੱਸਣਾ ਸੀਗਾ ਕਿ ਡਰਾਈਵਰ ਮੈਂ ਆਪਣੇ ਘਰਦਿਆਂ ਨੂੰ ਭੇਜਣ ਲਈ ਕੀਤਾ ਹੈ ਜੋ ਕਿ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਵੇਗਾ ਬਾਈ ਮੈਨੂੰ ਸਮਝ ਨਹੀਂ ਆ ਰਿਹਾ ਕਿ ਡਰਾਈਵਰ ਦਾ ਬਿਹੇਵੀਅਰ ਕਿਵੇਂ ਦਾ ਰਹੇਗਾ ਉਹਦੀ ਰੇਟਿੰਗ ਦੇ ਰਿਗਾਰਡਿੰਗ ਵੀ ਤੂੰ ਸਾਰੀ ਜਾਂਚ ਕੀਤੀ ਹੈ ਜਾਂ ਨਹੀਂ ਕੀਤੀ ਜੇ ਜਾਂਚ ਕੀਤੀ ਆ ਤਾਂ ਉਹਦੀ ਰੇਟਿੰਗ ਕਿਵੇਂ ਦੀ ਆ ਜਾਂ ਤਾਂ ਤੂੰ ਮੈਨੂੰ ਦੱਸਦੇ ਕੀ ਉਹਦੀ ਰੇਟਿੰਗ ਕਿਵੇਂ ਮੈਂ ਚੈੱਕ ਕਰ ਸਕਦਾ ਤਾਂ ਕਿ ਮੈਨੂੰ ਉਹਦਾ ਵੀ ਬਿਹੇਵੀਅਰ ਪਤਾ ਚੱਲ ਜਾਵੇ ਤਾਂਕਿ ਮੇਰੇ ਘਰਦਿਆਂ ਨਾਲ ਕੋਈ ਅਬੀ ਨਬੀ ਨਾ ਹੋ ਜਾਵੇ ਰਸਤੇ ਵਿੱਚ ਮੇਰੇ ਘਰਦਿਆਂ ਨੇ ਸ਼ਨੀਵਾਰ ਨੂੰ ਰਾਤੀਂ ਜਾਣਾ ਹੈ ਅਤੇ ਸੋਮ ਮੰਗਲਵਾਰ ਉੱਥੇ ਪਹੁੰਚ ਕੇ ਉੱਥੋਂ ਆਪਣਾ ਕੰਮ ਨਿਪਟਾ ਕੇ ਵਾਪਿਸ ਨੂੰ ਆਉਣਾ ਹੈ ਜਾਂ ਤਾਂ ਉਹ ਡਰਾਈਵਰ ਛੱਡੇਗਾ ਜਾਂ ਇੱਕੋ ਸਾਈਡ ਦਾ ਕਰ ਲਵਾਂ ਜਾਂ ਦੋਵੇਂ ਸਾਈਡਸ ਦਾ ਕਰ ਲਵਾਂ ਪਲੀਜ਼ ਮੈਨੂੰ ਇਹ ਚੀਜ਼ ਦਾ ਪੂਰੀ ਦੱਸਦੇ ਤਾਂ ਕੀ ਮੈਨੂੰ ਉਹਦੇ ਵੱਲੋਂ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮੇਰੇ ਪਰਿਵਾਰ ਵਾਲੇ ਸਹੀ ਸਲਾਮਤ ਚਲੇ ਜਾਣ ਅਤੇ ਆਰਾਮ ਨਾਲ ਫਰੂਟਫੁਲ ਖੁਸ਼ੀ ਨਾਲ ਵਾਪਿਸ ਆਉਣ ਮੈਂ ਇਸੇ ਕਰਕੇ ਤੈਨੂੰ ਵਾਰ ਵਾਰ ਫੋਨ ਕਰ ਰਿਹਾ ਸੀਗਾ ਸੋਰੀ ਯਾਰ ਤੈਨੂੰ ਤੰਗ ਕਰਨਾ ਪਿਆ ਪਰ ਪਲੀਜ਼ ਮੈਨੂੰ ਇਸ ਚੀਜ਼ ਬਾਰੇ ਪਹਿਲਾਂ ਪੂਰਾ ਦੱਸਦੇ ਤਾਂ ਕਿ ਮੈਂ ਉਹਦੀ ਰੇਟਿੰਗ ਵਗੈਰਾ ਚੈੱਕ ਕਰ ਲਵਾਂ